ਸ਼ੇਰ ਏ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ ਮੌਤ ਦਾ ਸਿੱਖ ਸਾਮਰਾਜ ਦੇ ਉੱਪਰ ਬਹੁਤ ਹੀ ਗਹਿਰਾ ਪ੍ਰਭਾਵ ਪਿਆ ਕਿਉਂਕਿ ਇਕੱਲੇ ਉਹਨਾਂ ਦੇ ਵਾਜੋਂ ਜਿਹੜੀਆਂ ਸਿੱਖ ਫੌਜਾਂ ਸੀਗੀਆਂ ਇੰਨੀਆਂ ਲੜਾਈਆਂ ਦੇ ਵਿੱਚੋਂ ਹਾਰ ਜਾਂਦੀਆਂ ਸੀ ਉਹਨਾਂ ਦੀਆਂ ਅਣਹੋਂਦ ਤੋਂ ਬਾਅਦ ਭਾਵੇਂ ਰਾਣੀ ਜਿੰਦ ਕੌਰ ਨੇ ਵਾਗਡੋਰ ਸੰਭਾਲੀ ਸੀ ਸਿੱਖ ਰਾਜ ਨੂੰ ਸੰਭਾਲਣ ਦੀ ਪਰ ਉਹ ਇੰਨੀ ਜ਼ਿਆਦਾ ਕਾਮਯਾਬ ਨਹੀਂ ਹੋਏ ਉਹਨਾਂ ਨੇ ਯਤਨ ਬਹੁਤ ਕੀਤੇ ਪਰ ਮਹਾਰਾਜ ਰਣਜੀਤ ਸਿੰਘ ਜੀ ਦੀ ਅਣਹੋਂਦ ਸਦਾ ਹੀ ਸਿੱਖ ਫੌਜਾਂ ਦੇ ਲਈ ਘਾਟ ਦਾ ਕਾਰਨ ਘਾਟ ਦਾ ਹਾਰ ਦਾ ਕਾਰਨ ਰਹੀ ਹੈਗੀ ਤੋ ਜੇ ਮਹਾਰਾਜ ਜੀ ਸਿੰਘ ਹੁੰਦੇ ਤਾਂ ਸਿੱਖ ਫੌਜਾਂ ਕਦੇ ਵੀ ਨਾ ਹਾਰਦੀਆਂ ਅਤੇ ਸਿੱਖ ਸਾਮਰਾਜ ਅੱਜ ਬੁਲੰਦੀਆਂ ਦੇ ਉੱਪਰ ਹੁੰਦਾ ਮਹਾਰਾਣੀ ਜਿੰਦ ਕੌਰ ਨੇ ਵੀ ਕਾਫ਼ੀ ਜ਼ਿਆਦਾ ਸੰਘਰਸ਼ ਕੀਤਾ ਬਹੁਤ ਜ਼ਿਆਦਾ ਯਤਨ ਕੀਤੇ ਪਰ ਉਹਨਾਂ ਨੂੰ ਇੰਨੀ ਕਾਮਯਾਬੀ ਪ੍ਰਾਪਤ ਨਹੀਂ ਹੋਈ